ਖੇਡਣ ਲਈ ਮੇਰੀ ਮਨਪਸੰਦ ਗੇਮ ਵਾਲੀਬਾਲ ਹੈ ਜਿਹਦੇ ਵਿੱਚ ਬਾਰਾਂ ਬੰਦਿਆਂ ਦੀ ਜ਼ਰੂਰਤ ਪੈਂਦੀ ਹੈ ਛੇ ਛੇ ਪਲੇਅਰ ਦੋਨੋਂ ਪਾਸੇ ਹੋ ਕੇ ਖੇਡਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ